ਸਾਡੇ ਪਿੰਡ ਵਿੱਚ ਇੱਕ ਡੇਰਾ ਹੈ ਡੇਰਾ ਮਤਲਬ ਕਿ ਸਾਧਾਂ ਦਾ ਡੇਰਾ ਜਿੱਥੇ ਸਾਧ ਰਹਿੰਦੇ ਨੇ ਮੈਂ ਨਾ ਉੱਥੇ ਉਹ ਸਾਧਾ ਦੀ ਤਪੱਸਿਆ ਤੋਂ ਇੰਨੀ ਜ਼ਿਆਦਾ ਹੈਰਾਨ ਹੋਈ ਆ ਮਤਲਬ ਕਿ ਜਦੋਂ ਸਰਦੀ ਦੇ ਵਿੱਚ ਕੋਰਾ ਪੈ ਰਿਹਾ ਹੁੰਦਾ ਉੱਥੇ ਸਾਧ ਤਪੱਸਿਆ ਕਰਦੇ ਨੇ ਦੋ ਸੋ ਕੁਛ ਘੜਾ ਉਹਨਾਂ ਦੇ ਸਿਰ ਦੇ ਵਿੱਚ ਪਾਇਆ ਜਾਂਦਾ ਠੰਡਾ ਜਿਹੜਾ ਕਿ ਰਾਤ ਨੂੰ ਭਰ ਕੇ ਰੱਖੇ ਜਾਂਦੇ ਆ ਅਤੇ ਸੁਬਾਹ ਚਾਰ ਵਜੇ ਉਹਨਾਂ ਦੇ ਸਿਰ ਵਿੱਚ ਪਾਇਆ ਜਾਂਦਾ ਜਦੋਂ ਉਹਨਾਂ ਨੂੰ ਘੜਾ ਪਾਉਣ ਤੋਂ ਬਾਅਦ ਉਠਾਇਆ ਜਾਂਦਾ ਆਰਾਮ ਨਾਲ ਉਹ ਉੱਠ ਖੜ੍ਹਦੇ ਆ ਕੋਈ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਕੋਈ ਸੁੰਨ ਨਹੀਂ ਚੜਿਆ ਹੁੰਦਾ ਨਾ ਉਹ ਬੇਹੋਸ਼ ਹੋਏ ਹੁੰਦੇ ਨਾ ਉਹਨਾਂ ਦੇ ਸਰੀਰ ਨੂੰ ਕੋਈ ਫਰਕ ਪਿਆ ਹੁੰਦਾ ਮਤਲਬ ਕਿ ਮੈਂ ਇਸ ਇਹਨਾਂ ਸਾ ਸਾਧੂ ਮਹੰਤਾਂ ਦੀ ਸ਼ਰਧਾ ਤੋਂ ਦੇਖ ਕੇ ਇੰਨੀ ਜ਼ਿਆਦਾ ਪ੍ਰਭਾਵਿਤ ਹੋਈ ਹਾਂ ਕਿ ਕਿਤੇ ਨਾ ਕਿਤੇ ਪਰਮਾਤਮਾ ਵਿੱਚ ਇਹਨਾਂ ਵਿੱਚ ਵੱਸਦਾ ਇੱਕ ਹੋਰ ਗੱਲ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਮੇਰੇ ਘਰ ਦੇ ਕੋਲ ਇੱਕ ਨਾ ਸੁੰਨ ਸਾਨ ਜਗ੍ਹਾ ਪਈ ਸੀ ਘਰ ਤੋਂ ਥੋੜ੍ਹੀ ਜਿਹੀ ਦੂਰ ਉੱਥੇ ਇੱਕ ਬਾਬਾ ਜੀ ਰਹਿੰਦੇ ਸੀ ਉਹ ਨਾ ਬਿਲਕੁਲ ਮਤਲਬ ਕਿ ਕੱਪੜੇ ਨਹੀਂ ਪਾਉਂਦੇ ਸੀ ਉਹਨਾਂ ਨੇ ਬਸ ਇੱਕ ਜੋ ਪਹਿਲਾਂ ਪਾਉਂਦੇ ਹੁੰਦੇ ਸੀਗੇ ਧੋਤੀ ਟਾਈਪ ਜੀ ਛੋਟੀ ਜਿਹੀ ਬਿਲਕੁਲ ਉਹੀ ਪਾਉਂਦੇ ਹੁੰਦੇ ਸੀ ਉਹਨਾਂ ਨੂੰ ਸਾਡੇ ਪਿੰਡ ਦੇ ਲੋਕ ਨਾਗਾ ਸਾਧ ਕਹਿ ਕੇ ਬੁਲਾਉਂਦੇ ਸੀ ਉਹ ਨਾ ਉੱਥੇ ਬੈਠੇ ਰਹਿੰਦੇ ਪਤਾ ਨਹੀਂ ਉਹ ਕਿੱਥੋਂ ਰੋਟੀ ਖਾਂਦੇ ਸੀ ਕਿੱਥੋਂ ਉਹ ਬਸ ਮਤਲਬ ਕਿ ਛੱਪੜੀ ਜਿਹੀ ਬਣੀ ਹੋਈ ਸੀ ਉੱਥੀ ਬੈਠੇ ਰਹਿੰਦੇ ਸੀ ਉਹ ਮਤਲਬ ਕਿ ਮੈਂ ਚਾਰ ਪੰਜ ਸਾਲ ਉਹਨਾਂ ਨੂੰ ਐਂ ਹੀ ਬੈਠੇ ਦੇਖਿਆ ਹੌਲੀ ਹੌਲੀ ਜਦੋਂ ਮੈਂ ਦੇਖਿਆ ਉੱਥੇ ਨਾ ਛੋਟਾ ਜਿਹਾ ਗੁਰਦੁਆਰਾ ਬਣ ਗਿਆ ਉਸ ਤੋਂ ਬਾਅਦ ਮੈਂ ਗੱਲ ਸੁਣੀ ਕਹਿੰਦੇ ਗੁਰਦੁਆਰੇ ਦੇ ਵਿੱਚ ਉਹ ਬਾਬਾ ਜੀ ਤਾਂ ਗੁਰਦੁਆਰਾ ਬਣਾ ਕੇ ਚਲੇ ਗਏ ਉਹਨਾਂ ਬਾਰੇ ਪਤਾ ਨਹੀਂ ਕਿੱਥੇ ਗਏ ਉਹ ਅਲੋਪ ਹੋ ਗਏ ਕਿੱਥੇ ਹੋ ਗਏ ਮੈਂ ਦੇਖਿਆ ਗੁਰਦੁਆਰੇ ਦੇ ਵਿੱਚ ਜੋ ਸੁੱਕੀਆਂ ਰੋਟੀਆਂ ਨਹੀਂ ਹੁੰਦੀਆਂ ਸੁੱਕੀਆਂ ਰੋਟੀਆਂ ਦੀ ਨਾ ਬੋਰੀ ਭਰੀ ਪਈ ਸੀ ਅਤੇ ਬਾਬਾ ਜੀ ਉੱਥੇ ਜਿਹੜੇ ਰੱਖੇ ਸੀ ਸੇਵਾ ਕਰਨ ਵਾਸਤੇ ਉਹਨਾਂ ਨੂੰ ਪਿੰਡ ਦੇ ਲੋਕਾਂ ਨੇ ਕਹਿ ਤਾ ਵੀ ਤੁਹਾਡੇ ਘਰ ਮੱਝਾਂ ਨੇ ਉਹਨਾਂ ਨੂੰ ਪਾ ਦਿਓ ਉਹ ਕਹਿੰਦੇ ਨਹੀਂ ਮੈਂ ਗੁਰਦੁਆਰੇ ਦੀ ਚੀਜ਼ ਘਰ ਨਹੀਂ ਲੈ ਕੇ ਜਾਂਦਾ ਥੋੜ੍ਹੇ ਚਿਰ ਬਾਅਦ ਜਦੋਂ ਉਹਨਾਂ ਨੇ ਜੋ ਉਥੇ ਸੇਵਕ ਸੀਗੇ ਕੰਮ ਕਰਨ ਵਾਲੇ ਉਹਨਾਂ ਨੇ ਜਦੋਂ ਦੇਖਿਆ ਰੋਟੀਆਂ ਦਾ ਬੂਰਾ ਬਣਿਆ ਪਿਆ ਸੀ ਇਹੀ ਗੁਰਦੁਆਰੇ ਦੀ ਕਰਾਮਾਤ ਮੈਂ ਦੇਖ ਕੇ ਬਹੁਤ ਪ੍ਰਭਾਵਿਤ ਹੋਈ